ਨਹੀਂ ਸਾਨੂੰ ਕੋਈ ਵੀ ਬੁਨਿਆਦਿਕ ਢਾਂਚਾ ਜਾਂ ਆਵਾਜਾਈ ਸਬੰਧਿਤ ਕੋਈ ਵੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸਾਨੂੰ ਨੇੜਲੇ ਸ਼ਹਿਰ ਦੀ ਯਾਤਰਾ ਕਰਨ ਲਈ ਕੋਈ ਵੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਵੇਂ ਕਿ ਹੁਣ ਛੇ ਲਾਈਨਾਂ ਵਾਲੇ ਰੋਡ ਬਣ ਚੁੱਕੇ ਨੇ ਬਹੁਤ ਹੀ ਜ਼ਿਆਦਾ ਵਧੀਆ ਰੋਡ ਆਉਣਾ ਜਾਣਾ ਟਾਈਮ 'ਤੇ ਬੱਸਾਂ ਮਿਲਦੀਆਂ ਨੇ ਆਉਣਾ ਜਾਣਾ ਬਹੁਤ ਜ਼ਿਆਦਾ ਸੌਖਾ ਹੋ ਚੁੱਕਿਆ ਹੈ ਅਤੇ ਬਹੁਤ ਹੀ ਜ਼ਿਆਦਾ ਵਧੀਆ ਅਗਰ ਬੱਸ ਨੂੰ ਟਾਈਮ ਉੱਥੇ ਬੈਠਣ ਲਈ ਬੱਸ ਸਟੋਪ 'ਤੇ ਬੈਠਣ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਕਿ ਬੰਦਾ ਆਰਾਮ ਨਾਲ ਵੇਟ ਕਰ ਸਕਦਾ ਬੈਠ ਕੇ ਬਹੁਤ ਹੀ ਜ਼ਿਆਦਾ ਵਧੀਆ ਆਉਣਾ ਜਾਣਾ ਹੋ ਜਾਂਦਾ ਹੈ ਜਿਵੇਂ ਕਿ ਹੁਣ ਬਹੁਤ ਹੀ ਜ਼ਿਆਦਾ ਵਧੀਆ ਰੋਡ ਬਣੇ ਹੋਏ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਰ ਇੱਕ ਬੰਦਾ ਟਾਈਮ ਨਾਲ ਜਾਣਾ ਜਾਂ ਆਉਣਾ ਬਹੁਤ ਵਧੀਆ ਹੋ ਜਾਂਦਾ ਹੈ ਜਿਸ ਕਾਰਨ ਕੋਈ ਵੀ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਕੋਈ ਐਵੇਂ ਦੀ ਕੋਈ ਦਿੱਕਤ ਆਉਦੀ ਹੈ ਬਹੁਤ ਜ਼ਿਆਦਾ ਵਧੀਆ ਰੋਡ ਨੇ ਆਉਣਾ ਜਾਣਾ ਟ੍ਰੈਫਿਕ ਘੱਟ ਨਹੀਂ ਬਹੁਤ ਘੱਟ ਹੈ ਜਿਵੇਂ ਕਿ ਛੇ ਲਾਈਨਾਂ ਵਾਲਾ ਰੋਡ ਹੈ ਟ੍ਰੈਫਿਕ ਬਹੁਤ ਜ਼ਿਆਦਾ ਘੱਟ ਲੱਗਦੀ ਹੈ ਇਵੇਂ ਹੀ ਆਉਣਾ ਜਾਣਾ ਬਹੁਤ ਜ਼ਿਆਦਾ ਸੌਖਾ ਹੋ ਚੁੱਕਿਆ ਹੈ